ਦੇਖਣ ਵਾਲ਼ੀਆਂ ਥਾਵਾਂ ਵਿੱਚ ਬਹੁਤ ਸਾਰੀਆਂ ਥਾਵਾਂ ਨੇ ਜਿਨ੍ਹਾਂ 'ਚੋਂ ਸਾਰਿਆਂ ਤੋਂ ਪਹਿਲਾਂ ਆਉਂਦਾ ਹੈ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਦਰਬਾਰ ਸਾਹਿਬ ਜਿਹੜਾ ਕਿ ਸਿੱਖਾਂ ਦਾ ਬਹੁਤ ਪਵਿੱਤਰ ਅਤੇ ਪ੍ਰਸਿੱਧ ਇਤਿਹਾਸਕ ਸਥਾਨ ਹੈ ਜਿਸ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਤੋਂ ਇਲਾਵਾ ਜਲਿਆਂਵਾਲਾ ਬਾਗ ਜਿਹੜਾ ਕਿ ਗੋਲਡਨ ਟੈਂਪਲ ਦੇ ਬਿਲਕੁਲ ਹੀ ਨਾਲ਼ ਹੈ ਉਹ ਵੀ ਬਹੁਤ ਇਤਿਹਾਸਕ ਅਤੇ ਪ੍ਰਸਿੱਧ ਇਸਤਿਆ ਦੇਖਣ ਵਾਲਾ ਸਥਾਨ ਹੈ ਇਸ ਸਥਾਨ 'ਤੇ ਪਹੁੰਚ ਕੇ ਸਾਨੂੰ ਉਹ ਪੁਰਾਣੇ ਟਾਇਮ ਦੀ ਯਾਦ ਆ ਜਾਂਦੀ ਹੈ ਜਦੋਂ ਕਿ ਅੰਗਰੇਜ਼ ਹਕੂਮਤ ਨੇ ਉੱਥੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਸਿੱਖ ਮਿਊਜ਼ੀਅਮ ਵੀ ਬਹੁਤ ਪ੍ਰਸਿੱਧ ਅਤੇ ਇਤਿਹਾਸਕ ਸਥਾਨ ਹੈ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਬਹੁਤ ਮਸ਼ਹੂਰ ਅਤੇ ਬਹੁਤ ਹੀ ਰੋਮਾਂਚਕ ਦ੍ਰਿਸ਼ ਹੈ ਜਿਹੜਾ ਕਿ ਵੇ ਵੇਖਣ ਲਈ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕਰਤਾਰਪੁਰ ਬਹੁਤ ਇਤਿਹਾਸਕ ਸਥਾਨ ਬਣ ਚੁੱਕਿਆ ਹੈ ਜਿੱਥੇ ਕਿ ਬਿਨਾ ਕਿਸੇ ਵਿਜ਼ੇ ਤੋਂ ਦ ਦਰਸ਼ਨ ਕਰਨ ਲਈ ਪਹੁੰਚਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਸਾਇੰਸ ਸਿਟੀ ਕਪੂਰਥਲਾ ਵਿੱਚ ਬਹੁਤ ਹੀ ਜਾਣਕਾਰੀ ਦੇਣ ਵਾਲੀ ਥਾਂ ਹੈ ਇਸ ਤੋਂ ਇਲਾਵਾ ਰੌਕ ਗਾਰਡਨ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਹ ਵੀ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਦੇਖਣ ਵਾਲੀ ਥਾਂ ਹੈ